ਮੈਂ ਹਰਮਨਜੀਤ ਅਸੀਂ ਪੁਰਾਣੀ ਪੀੜ੍ਹੀਆਂ ਤੋਂ ਹੀ ਪਸ਼ੂ ਰੱਖਦੇ ਆ ਰਹੇ ਹਾਂ ਜਿਵੇਂ ਮੱਝਾਂ ਗਾਈਆਂ ਆਦਿ ਸਡ ਜਦੋਂ ਵੀ ਕੋਈ ਮੱਝ ਕੋਈ ਬੱਚੇ ਨੂੰ ਜਨਮ ਦਿੰਦੀ ਹੈ ਅਸੀਂ ਉਸਦੀ ਬਹੁਤ ਹੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਾਂ ਉਸਨੂੰ ਗੁੜ ਸੋਏ ਦਿੰਦੇ ਹਾਂ ਉਸ ਨੂੰ ਦਲ ਗਰਮ ਘ ਰਿਝਾ ਕੇ ਦਲੀਆ ਦਿੰਦੇ ਹਾਂ ਅਤੇ ਉਸਦੀ ਬਹੁਤ ਹੀ ਅੱਛੇ ਤਰੀਕੇ ਨਾਲ ਦੇਖਭਾਲ ਕਰਦੇ ਹਾਂ ਉਸ ਨੂੰ ਦੋ ਅਤੇ ਉਸ ਨੂੰ ਚਾਰ ਪੰਜ ਦਿਨ ਗਰਮ ਪਾਣੀ ਨਾਲ ਨਲਾਇਆ ਜਾਂਦਾ ਉਸਦੀ ਸਾਫ ਸਫਾਈ ਕੀਤੀ ਜਾਂਦੀ ਹੈ ਅਤੇ ਉਸਦੀ ਮਾਂ ਨੂੰ ਵੀ ਗਰਮ ਪਾਣੀ ਨਾਲ ਨਲਾਇਆ ਜਾਂਦਾ ਹੈ ਉਸ ਦੀ ਅਤੇ ਉਸਦੀ ਬਹੁਤ ਅੱਛੀ ਨਾਲ ਦੇਖਭਾਲ ਕੀਤੀ ਜਾਂਦੀ ਹੈ